ਸਾਡੇ ਬਾਗਵਾਨੀ ਦਾ ਬਹੁਤ ਕਾਫ਼ੀ ਬੰਦਿਆਂ ਨੂੰ ਸ਼ੌਂਕ ਹੈ ਮੈਂ ਆਪਣਾ ਹੀ ਘਰ ਦੇ ਵਿੱਚ ਕਾਫ਼ੀ ਕਿਆਰੀਆਂ ਬਣਾ ਕੇ ਅਤੇ ਸਬਜ਼ੀਆਂ ਵਗੈਰਾ ਲਗਾਉਂਦਾ ਰਹਿੰਦਾ ਹਾਂ ਖਾਦ ਮੈਂ ਪਾਉਂਦਾ ਹਾਂ ਗੋਬਰ ਦੀ ਅਤੇ ਬਹੁ ਗਡਾਈ ਵਗੈਰਾ ਕਰ ਕੇ ਕਾਫ਼ੀ ਸਬਜ਼ੀਆਂ ਇੱਕ ਵੇਲ ਤੋਂ ਹੀ ਲੈ ਲੈਂਦਾ ਹਾਂ ਘੀਆ ਹੋਵੇ ਕੱਦੂ ਹੋਵੇ ਕਰੇਲਿਆਂ ਦੀ ਵੇਲ ਮੇਰੀ ਇੰਨੀ ਵੱਡੀ ਹੋ ਗਈ ਹੈ ਮੈਂ ਤਾਰਾਂ ਬੰਨ ਕੇ ਉੱਪਰ ਕਾਫ਼ੀ ਦੂਰ ਤੱਕ ਓਹਨੂੰ ਬਿਛਾਇਆ ਹੋਇਆ ਹੈ ਉਹ ਕਾਫ਼ੀ ਮੈਨੂੰ ਕਰੇਲੇ ਦਿੰਦੀ ਹੈ ਨਾਲ਼ੇ ਹੋਰ ਵੀ ਆਂਢ ਗੁਆਂਢ ਨੂੰ ਵੀ ਦੇ ਹੋ ਜਾਂਦੇ ਨੇ ਕਾਫ਼ੀ ਸਬਜ਼ੀਆਂ ਦਾ ਬੜਾ ਸ਼ੋਂਕ ਹੈ ਮੈਂ ਗਮਲੇ ਮਿੱਟੀ ਦੇ ਲਿਆ ਕੇ ਵੀ ਓਹਨਾਂ ਦੇ ਵਿੱਚ ਵੀ ਮਿਰਚਾਂ ਦੇ ਪੌਦੇ ਬੈਂਗਣਾ ਦੇ ਅਤੇ ਕਾਫ਼ੀ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੂਟੇ ਵਗੈਰਾ ਲਾਉਣ ਦਾ ਬਹੁਤ ਮੈਨੂੰ ਆ ਆਦਤ ਹੈ ਸ਼ੁਰੂ ਤੋਂ ਹੀ ਬਸ ਫੁੱਲ ਵਗੈਰਾ ਵੀ ਮੈਂ ਲਾ ਗਾ ਕੇ ਰੱਖਦਾ ਹਾਂ ਲਗਾਏ ਹੋਏ ਨੇ ਬਹੁਤ ਗੁਲਾਬ ਹੋਇਆ ਗੇਂਦਾ ਹੋਇਆ ਜਿਹੋ ਚੀਜ਼ਾਂ ਵੀ ਬੜੀਆਂ ਸੋਹਣੀਆਂ ਲਗਦੀਆਂ ਨੇ ਧਰਤੀ ਦੀ ਸਜਾਵਟ ਰਹਿੰਦੀ ਹੈ ਅਤੇ ਗਮਲਿਆਂ ਨੂੰ ਵੀ ਸੁਬਾਹ ਸ਼ਾਮ ਧਿਆਨ ਨਾਲ਼ ਦੇਖ ਕੇ ਉਹਨਾਂ ਨੂੰ ਪਾਣੀ ਵੀ ਮਿਲਦਾ ਹੈ ਕਾਫ਼ੀ ਫਾਇਦੇ ਮੈਂ ਆਪਣੀ ਸਬਜ਼ੀਆਂ ਆਪ ਬਗੀਚੇ ਨੂੰ ਤਿਆਰ ਕਰਕੇ ਮੈਂ ਲੋਨ ਵਗੈਰਾ ਵੀ ਬਣਾਇਆ ਹੋਇਆ ਹੈ ਉਹਦੇ ਵਿੱਚ ਵੀ ਘਾਹ ਲਾ ਕੇ ਬੈਠਣ ਲਈ ਸੁਬਾਹ ਸ਼ਾਮ ਬੜੇ ਆਰਾਮ ਨਾਲ਼ ਬੜਾ ਚੰਗਾ ਸੋਹਣਾ ਮੈਨੂੰ ਲੱਗਦਾ ਹੈ ਮੈਂ ਕਾਫੀ ਮਿਹਨਤ ਕਰਦਾ ਹਾਂ ਮੈਨੂੰ ਬੜਾ ਸ਼ੌਂਕ ਹੈ ਸਬਜ਼ੀਆਂ ਲਗਾਉਣ ਦਾ ਅਤੇ ਹੋਰ ਵੀ ਬੂਟੇ ਫ਼ਲਦਾਰ ਬੂਟੇ ਵੀ ਮੈਂ ਘਰ ਦੇ ਵਿੱਚ ਥੋ ਥੋੜੀ ਥੋੜੀ ਜਗ੍ਹਾ ਦੇ ਵਿੱਚ ਹੀ ਲਗਾਏ ਹੋਏ ਹਨ ਮਰੂਦ ਵਗੈਰਾ ਸਾਰੇ ਅਨਾਰ ਦਾ ਬੂਟਾ ਮੈਂ ਵਿਹੜੇ ਦੇ ਵਿੱਚ ਛੋਟਾ ਜਾ ਖੱਡਾ ਕਰ ਕੇ ਬੜਾ ਸੋਹਣਾ ਕਾਫੀ ਬੜਾ ਹੋ ਗਿਆ ਓਹਨੂੰ ਬਹੁਤ ਅਨਾਰ ਲੱਗਦੇ ਹਨ ਅਤੇ ਨਿੰਬੂਆਂ ਦਾ ਬੂਟਾ ਵੀ ਕਾਫ਼ੀ ਮੇਰੇ ਕੋਲ ਬੜਾ ਤਕੜਾ ਬੜਾ ਸ਼ੌਂਕ ਮੈਨੂੰ ਸਭ ਚੀਜ਼ ਦਾ ਬੜਾ ਸ਼ੌਂਕ ਹੈ ਫ਼ਲ਼ ਫਰੂਟ ਵੀ ਮੈਂ ਕਾਫ਼ੀ ਲਗਾਏ ਹੋਏ ਹਨ ਅਤੇ ਸਾਰੇ ਬੜੇ ਆਰਾਮ ਨਾਲ਼ ਪ ਵਧੀਆ ਓਹਨਾਂ ਦੀ ਦੇਖਭਾਲ ਕਰੀਦੀ ਹੈ ਮਾੜੀ ਮੋਟੀ ਓਹਨਾਂ ਤੇ ਜਿਵੇਂ ਕੀ ਹੈ ਇਹ ਨਿੰਮ ਦੇ ਪੱਤੇ ਅਤੇ ਹੋਰ ਵਗੈਰਾ ਇਹ ਡੇਕ ਦੇ ਡੇਕ ਦੇ ਪੱਤਿਆਂ ਨੂੰ ਉਬਾਲ ਕੇ ਮੈਂ ਓਹਨਾਂ ਨੂੰ ਉਬਾਲ ਕੇ ਪਾਣੀ ਓਹਨਾਂ ਦੇ ਉੱਪਰ ਛਿੜਕ ਕੇ ਅਤੇ ਕੀੜੇ ਤੋਂ ਵੀ ਓਹਨਾਂ ਦਾ ਬਚਾਓ ਰੱਖਦਾ ਹਾਂ